ਹਾਂਜੀ ਸਾਡੇ ਨਾ ਜਿਹੜੇ ਸਮਾਜ ਦੇ ਵਿੱਚ ਨਾ ਮਾਰਸ਼ਲ ਆਰਟਸ ਨੂੰ ਨਾ ਆਮ ਤੌਰ 'ਤੇ ਨਾ ਲੜਾਈ ਝਗੜੇ ਨਾਲ ਹੀ ਜੋੜਿਆ ਜਾਂਦਾ ਹੈਗਾ ਪਰ ਨਾ ਜੇ ਆਪਾਂ ਦੀ ਗੱਲ ਕਰੀਏ ਇਹ ਨਾ ਸਰੀਰਕ ਕੌਸ਼ਲਾਂ ਤੱਕ ਹੀ ਸੀਮਤ ਨਹੀਂ ਗਾ ਠੀਕ ਆ ਮਾਰਸ਼ਲ ਆਰਟਸ ਦੇ ਵਿੱਚ ਅਸੀਂ ਅਨੁਸ਼ਾਸਨ ਸਵਰ ਆਤਮ ਵਿਸ਼ਵਾਸ ਵਰਗੀਆਂ ਮਾਨਸਿਕ ਜਿਹੜੀਆਂ ਤਾਕਤਾਂ ਗੀਆਂ ਉਹ ਵੀ ਸਾਡੇ ਦੇ ਵਿੱਚ ਵਿਕਸਿਤ ਹੁੰਦੀਆਂ ਨੇ ਠੀਕ ਹੈ ਇਹਨਾਂ ਤਾਕਤਾਂ ਦਾ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈਗਾ ਅਤੇ ਜਦੋਂ ਆਪਾਂ ਨਾ ਮਾਰਟਸ ਮਾਰਸ਼ਲ ਆਰਟਸ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਕਸਰ ਅਗਰ ਜਿਹੜਾ ਸਰੀਰਕ ਅਤੇ ਆ ਲੜ ਸਾਨੂੰ ਐਂ ਲੜਾਈ ਝਗੜੇ ਵਾਲਾ ਕੰਮ ਹੀ ਹੈਗਾ ਨਹੀਂ ਇਹ ਜਿਹੜਾ ਸਾਨੂੰ ਫੋਕਸ ਕਰਦਾ ਹੈਗਾ ਧਿਆਨ ਕੇਂਦਰਿਤ ਕਰਦਾ ਹੈਗਾ ਕਾਹਦੇ 'ਤੇ ਕਰਦਾ ਹੈਗਾ ਅਨੁਸ਼ਾਸਨ 'ਤੇ ਸਵਰ ਅਤੇ ਆਤਮ ਵਿਸ਼ਵਾਸ ਅਤੇ ਫੋਕਸ ਵਰਗੀਆਂ ਮਾਨਸਿਕ ਤਾਕਤਾਂ ਨੂੰ ਸਾਡੇ ਅੰਦਰ ਨਾ ਵਿਕਸਿਤ ਕਰਦਾ ਹੈਗਾ ਜਿਹੜੀਆਂ ਇਹ ਤਾਕਤਾਂ ਗੀਆਂ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਣ ਹਨ ਉਦਾਹਰਨ ਦੇ ਤੌਰ 'ਤੇ ਜੇ ਮੈਂ ਤੁਹਾਨੂੰ ਤੁਹਾਡੇ ਨਾਲ ਆਪਣੀ ਨਾ ਗੱਲ ਸਾਂਝੀ ਕਰਦਾ ਅਨੁਸ਼ਾਸਨ ਸਾਨੂੰ ਆਪਣੇ ਸਮੇਂ ਦਾ ਪ੍ਰਬੰਧਨ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਸਾਡੀ ਜ਼ਿੰਦਗੀ ਨੂੰ ਸੰਗਠਿਤ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਸਬਰ ਆ ਜਿਹੜਾ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਨਿਰਾਸ਼ਾ ਨਾਲ ਨਜਿੱਠਣ ਅਤੇ ਸਾਡੇ ਟੀਚਿਆਂ ਨੂੰ ਹਾਸਿਲ ਕਰਨ ਦੇ ਲਈ ਲੋੜੀਂਦੀ ਸੰਘਰਸ਼ ਕਰਨ ਵਿੱਚ ਮਦਦ ਕਰਦਾ ਸਾਡੀ ਅਤੇ ਆਤਮ ਵਿਸ਼ਵਾਸ ਹੈ ਸਾਨੂੰ ਆਪਣੀਆਂ ਕਾਬਲੀਅਤਾਂ ਦੇ ਵਿੱਚ ਵਿਸ਼ਵਾਸ ਕਰਨ ਅਤੇ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦਾ ਜੋਖਮ ਲੈਣ ਵਿੱਚ ਮਦਦ ਕਰਦਾ ਇਸ ਲਈ ਮਾਰਸ਼ਲ ਆਰਟਸ ਸਿਰਫ ਸਰੀਰਕ ਤਾਕਤ ਵਧਾਉਣ ਦਾ ਸਾਧਨ ਨਹੀਂ ਇਹ ਸਾਨੂੰ ਸਰਬ ਪੱਖੀ ਤੌਰ 'ਤੇ ਵਿਕਾਸ ਕਰਨ ਦੇ ਵਿੱਚ ਸਾਡੀ ਮਦਦ ਕਰਦਾ ਹੈਗਾ ਇਹ ਸਾਨੂੰ ਸਰੀਰਕ ਤੌਰ 'ਤੇ ਮਜ਼ਬੂਤ ਮਾਨਸਿਕ ਤੌਰ 'ਤੇ ਸੰਤੁਲਨ ਅਤੇ ਸਮਾਜਿਕ ਤੌਰ 'ਤੇ ਜਾਗਰੂਕ ਬਣਾਉਣ ਦੇ ਵਿੱਚ ਸਾਡੀ ਮਦਦ ਕਰਦਾ ਹੈਗਾ ਅਤੇ ਠੀਕ ਹੈ ਜੀ ਅਤੇ ਬਸ ਆਪਾਂ ਇਹੀ ਕਹਿ ਸਕਦੇ ਹਾਂ ਜਿਹੜਾ ਮਾਰਸ਼ਲ ਆਰਟਸ ਹੈਗਾ ਇਸ 'ਚ ਅਸੀਂ ਦੂਜਿਆਂ ਨੂੰ ਦੇਖ ਕੇ ਵੀ ਅਸੀਂ ਪ੍ਰੇਰਿਤ ਹੁੰਦੇ ਆਗੇ ਅਤੇ ਜੋ ਕਰਦੇ ਹਾਂ ਅਤੇ ਇਹਦੇ ਨਾਲ ਸ਼ਕਤੀਸ਼ਾਲੀ ਤਾਂ ਅਸੀਂ ਆਪ ਹੀ ਬਣਦੇ ਹਾਂ ਵੀ ਇਕੱਲੇ ਸਰੀਰਕ ਤੌਰ 'ਤੇ ਸ਼ਕਤੀਸ਼ਾਲੀ ਨਹੀਂ ਅਸੀਂ ਬਣਦੇ ਮਾਰਸ਼ਲ ਆਰਟ ਦੇ ਨਾਲ ਵੀ ਸਾਡੇ ਵਿੱਚ ਕੋਂਫੀਡੈਂਸ ਵੀ ਪੈਦਾ ਹੁੰਦਾ ਸਬਰ ਵੀ ਹੁੰਦਾ ਹੈਗਾ ਠੀਕ ਹੈ ਅਸੀਂ ਅਨੁਸ਼ਾਸਨ ਦੇ ਵਿੱਚ ਵੀ ਰਹਿਣਾ ਸਿੱਖਦੇ ਹੈਗੇ ਅਤੇ ਸੱਚ ਕੀ ਹੈ ਮੈਨੂੰ ਉਮੀਦ ਹੈ ਜਿਹੜੇ ਮੇਰੇ ਵਿਚਾਰ ਹੈ ਤੁਹਾਨੂੰ ਜਿਹੜੇ ਜ਼ਰੂਰ ਪਸੰਦ ਆਏ ਹੋਣਗੇ ਜੀ ਬਹੁਤ ਬਹੁਤ ਧੰਨਵਾਦ ਜੀ